ਅਸੀਂ ਨੇੜਲੇ ਕਸਬਿਆਂ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਹਾਂ ਅਸੀਂ ਖੇਤੀਬਾੜੀ ਦਾ ਕੰਮ ਕਰਨ ਵਾਸਤੇ ਪਿੰਡਾਂ ਵਿੱਚ ਆਉਣ ਜਾਣ ਬਣਿਆ ਰਹਿੰਦਾ ਹੈ ਅਸੀਂ ਖੇਤੀਬਾੜੀ ਦੇ ਸੰਦ ਘਰ ਤੋਂ ਖੇ ਖੇ ਕਸਬਿਆਂ ਤੱਕ ਲਿਜਾਣ ਲਈ ਸਾਡਾ ਆਉਣ ਜਾਣ ਰਹਿੰਦਾ ਹੈ ਅਸੀਂ ਹ ਸਾਡੇ ਹੋਰ ਪਿੰਡਾਂ ਵਿੱਚ ਰਿਸ਼ਤੇਦਾਰ ਵੀ ਹਨ ਅਤੇ ਸਾਡਾ ਉਹਨਾਂ ਦੇ ਘਰ ਵਿੱਚ ਮਿਲਵਰਤਨ ਆਉਣ ਜਾਣ ਰਹਿੰਦਾ ਹੈ ਅਸੀਂ ਉਹਨਾਂ ਤੋਂ ਰੇਅ ਸ ਹੋਰ ਸਪਰੇਹਾਂ ਵਾਸਤੇ ਆਉਣ ਜਾਣ ਰਹਿੰਦਾ ਹੈ ਅਸੀਂ ਉਹਨਾਂ ਤੋਂ ਰੇਅ ਆਦਿ ਦੀ ਲੈਣ ਵਾਸਤੇ ਉਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਹਾਂ ਸਾਡਾ ਉ ਉਹਨਾਂ ਦੇ ਘਰ ਵਿੱਚ ਕਾਫੀ ਮਿਲਵਰਤਨ ਰਹਿੰਦਾ ਹੈ